ਮੋਹਾਲੀ ਜ਼ਿਲ੍ਹਾ ਇੱਕ ਵਿਕਸਿਤ ਖੇਤਰ ਹੈ ਇੱਥੇ ਬਹੁਤ ਤਰ੍ਹਾਂ ਦੇ ਰੁਜ਼ਗਾਰ ਵਿਕਸਿਤ ਹਨ ਇਹ ਰੁਜ਼ਗਾਰ ਪ੍ਰਾਈਵੇਟ ਅਤੇ ਸਰਕਾਰੀ ਸੰਸਥਾਵਾਂ ਵੱਲੋਂ ਲੋਕਾਂ ਨੂੰ ਦਿੱਤੇ ਜਾਂਦੇ ਹਨ ਇਹਨਾਂ ਕੰਮਾਂ ਵਿੱਚ ਛੋਟੇ ਅਤੇ ਵੱਡੇ ਕੰਮ ਸ਼ਾਮਿਲ ਹਨ ਜਿਨ੍ਹਾਂ ਨੂੰ ਵਿਅਕਤੀ ਕਰਕੇ ਆਪਣੀ ਰੋਜ਼ੀ ਰੋਟੀ ਚਲਾਉਂਦੇ ਹਨ ਸਰਕਾਰ ਵੱਲੋਂ ਵੀ ਰੁਜ਼ਗਾਰ ਮੇਲੇ ਲਗਾਏ ਜਾਂਦੇ ਹਨ ਤਾਂ ਜੋ ਹਰ ਇੱਕ ਵਿਅਕਤੀ ਨੂੰ ਨੌਕਰੀ ਮਿਲਣੀ ਜ਼ਰੂਰੀ ਹੋਵੇ ਇਹਨਾਂ ਨੌਕਰੀ ਮਿਲ ਸਕੇ ਕੁਝ ਲੋਕ ਸਰਕਾਰੀ ਨੌਕਰੀਆਂ ਕਰਨੀਆਂ ਪਸੰਦ ਕਰਦੇ ਹਨ ਅਤੇ ਕੁਝ ਪ੍ਰਾਈਵੇਟ ਖੇਤਰ ਵਿੱਚ ਕੰਮ ਕਰਨਾ ਪਸੰਦ ਕਰਦੇ ਹਨ ਹਰ ਨੌਕਰੀ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਚਾਹੇ ਉਹ ਕਿਸੀ ਵੀ ਖੇਤਰ ਵਿੱਚ ਹੋਵੇ ਵੱਧਦੀ ਆਬਾਦੀ ਕਰਕੇ ਸਾਡੇ ਖੇਤਰ ਵਿੱਚ ਰੁਜ਼ਗਾਰਾਂ ਦੀ ਕਮੀ ਹੋਈ ਹੈ ਮੇਰੇ ਅਨੁਸਾਰ ਸਰਕਾਰ ਨੂੰ ਰੁਜ਼ਗਾਰਾਂ ਨੂੰ ਚਲਾਉਣ ਲਈ ਉਦਯੋਗਿਕ ਖੇਤਰ ਨੂੰ ਹੋਰ ਵਿਕਸਿਤ ਕਰਨਾ ਚਾਹੀਦਾ ਹੈ ਬੇਰੁਜ਼ਗਾਰੀ ਭੱਤਾ ਦੇਣਾ ਚਾਹੀਦਾ ਹੈ ਹੋਰ ਵੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਰੁਜ਼ਗਾਰ ਮਿਲ ਸਕੇ